ਗਾਉਂਦੇ ਸਮੇਂ ਸਾਨੂੰ ਆਪਣੇ ਸਰੀਰ 'ਤੇ ਚਿਹਰੇ ਦੇ ਉੱਤੇ ਹਾਵ ਭਾਵ ਬਦਲਾਉਣੇ ਚਾਹੀਦੇ ਨੇ ਅਤੇ ਸਾਨੂੰ ਆਪਣਾ ਜਦੋਂ ਅਸੀਂ ਗਾਣਾ ਗਾਉਂਦੇ ਹਾਂ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਹੈ ਨਾ ਅਤੇ ਸਾਹਮਣੇ ਬੈਠ ਕੇ ਜੋ ਸਾਨੂੰ ਸੁਣਦਾ ਹੁੰਦਾ ਕੋਈ ਹੈ ਨਾ ਅਸੀਂ ਉਹਨੂੰ ਵੀ ਦੇਖਦੇ ਹਾਂ ਵੀ ਸਾਡਾ ਗਾਣਾ ਉਹਨੂੰ ਕਿੱਦਾਂ ਦਾ ਲੱਗਦਾ ਹੈਗਾ ਅਤੇ ਜੇ ਉਹ ਖੁਸ਼ ਹੁੰਦੇ ਆ ਸਾਡਾ ਹੋਰ ਵੀ ਹੌਸਲਾ ਵੱਧ ਜਾਂਦਾ ਗਾਉਣ ਵਾਸਤੇ ਅਤੇ ਮੈਨੂੰ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਜਿਵੇਂ ਨੱਚਣਾ ਟੱਪਣਾ ਗਾਉਣਾ ਗਾਉਂਦੇ ਸਮੇਂ ਹੈ ਨਾ ਕਿਸੇ ਨੂੰ ਨਾਲ ਹੋਰ ਨੂੰ ਗਵਾਉਣਾ ਇਹ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਅਸੀਂ ਗਾਉਣੇ ਹਾਂ ਤਾਂ ਜਿਵੇਂ ਹੁਣ ਮੇਰੇ ਭਤੀਜੇ ਦਾ ਵਿਆਹ ਸੀ ਭਤੀਜੇ ਦੇ ਵਿਆਹ ਵਿੱਚ ਬਹੁਤ ਗਾਣੇ ਗਾਏ ਘੋੜੀਆਂ ਗਾਈਆਂ ਮਨ ਨੂੰ ਬਹੁਤ ਸਕੂਨ ਮਿਲਦਾ ਜੇ ਅਸੀਂ ਗਾਵਾਂਗੇ ਤਾਂ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਖੁਸ਼ੀ ਦੇ ਨਾਲ ਸਾਨੂੰ ਹੋਰ ਵੀ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਸਾਨੂੰ ਹਮੇਸ਼ਾ ਗਾਉਣਾ ਵੀ ਚਾਹੀਦਾ ਹੈ ਨਾ ਅੱਜ ਕੱਲ੍ਹ ਜੋ ਚੱਲਦੇ ਆ ਹਾਲਾਤ ਉਹਨਾਂ ਦੇ ਵਿੱਚ ਵੀ ਜੇ ਆਪਾਂ ਗਾਉਂਦੇ ਰਹੀਏ ਤਾਂ ਸਾਡੇ ਜਿਹੜਾ ਮਨ ਦਾ ਸਕੂਨ ਆ ਉਹ ਬਹੁਤ ਵਧੀਆ ਰਹਿੰਦਾ ਗਾ ਅਤੇ ਦਿਮਾਗ ਵੀ ਰਿਲੈਕਸ ਰਹਿੰਦਾ ਸਾਨੂੰ ਗਾਉਣਾ ਵੀ ਚਾਹੀਦਾ ਰਿਸ਼ਤੇਦਾਰੀਆਂ ਦੇ ਵਿੱਚ ਜਾ ਕੇ ਵੀ ਸਾਨੂੰ ਸੰਗਣਾ ਨਹੀਂ ਚਾਹੀਦਾ ਗਾਉਣਾ ਹੀ ਚਾਹੀਦਾ ਸਾਨੂੰ ਅਤੇ ਸਾਨੂੰ ਐਂ ਹੁੰਦਾ ਵੀ ਜੋ ਅਸੀਂ ਗਾਣਾ ਗਾਉਂਦੇ ਹਾਂ ਸਾਡਾ ਗਾਣਾ ਦੇਖ ਕੇ ਹੈ ਨਾ ਖੁਸ਼ ਹੋਣ ਅਤੇ ਉਹਨਾਂ ਦਾ ਵੀ ਮਨ ਗਾਉਣ ਨੂੰ ਕਰੇ ਅਤੇ ਹਮੇਸ਼ਾ ਹੀ ਸਾਨੂੰ ਗਾਉਂਦੇ ਰਹਿਣਾ ਚਾਹੀਦਾ ਹੈਗਾ ਅਤੇ ਸਰੀਰ ਵੀ ਤੰਦਰੁਸਤ ਰਹਿੰਦਾ ਸਾਨੂੰ ਹਮੇਸ਼ਾ ਹੀ ਤੰਦਰੁਸਤੀ ਦੇ ਨਾਲ ਜੇ ਸਾਡਾ ਸਰੀਰ ਤੰਦਰੁਸਤ ਹੈ ਤਾਂ ਅਸੀਂ ਗਾਉਂਦੇ ਰਹਾਂਗੇ ਗਾਣੇ ਅਤੇ ਤੰਦਰੁਸਤ ਰਹਾਂਗੇ ਧੰਨਵਾਦ ਜੀ